ਭੰਗੜਾ ਐਰੋਬਿਕਸ ਕਰਨ ਨਾਲ ਸਾਡੇ ਜੀਵਨ 'ਤੇ ਬਹੁਤ ਸਾਰਾ ਪ੍ਰਭਾਵ ਪੈਂਦਾ ਹੈ ਇਸ ਨਾਲ ਸਾਡੀ ਸਿਹਤ ਸਿਹਤ ਵਧੀਆ ਰਹਿੰਦੀ ਹੈ ਇਸ ਨਾਲ ਅਸੀਂ ਆਪਣੇ ਭਾਰ ਨੂੰ ਵੀ ਘਟਾ ਸਕਦੇ ਹਾਂ ਇਸ ਨਾਲ ਇਹ ਕਰਨ ਨਾਲ ਸਾਡੇ ਦਿਲ ਅਤੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਇਸ ਨਾਲ ਸਾਨੂੰ ਅੰਦਰੂਨੀ ਖੁਸ਼ੀ ਪ੍ਰਦਾਨ ਹੁੰਦੀ ਹੈ ਜੇਕਰ ਬੱਚੇ ਰੋਜ਼ਾਨਾ ਦਸ ਮਿੰਟ ਇਸ ਭੰਗੜਾ ਐਰੋਬਿਕਸ ਕਰਨ ਤਾਂ ਉਹਨਾਂ ਉਹਨਾਂ ਲਈ ਉਹਨਾਂ ਦੇ ਜੀਵਨ ਬਹੁਤ ਸਵਰ ਸਕਦਾ ਹੈ ਉਹਨਾਂ ਨੂੰ ਪੜ੍ਹਾਈ ਦੀ ਬੋਝ ਤੋਂ ਵੀ ਖੁਸ਼ੀ ਮਿਲ ਸਕਦੀ ਹੈ ਇਸ ਨੂੰ ਕਰਨ ਨਾਲ ਸਾਡਾ ਮਨ ਅਤੇ ਦਿਮਾਗ ਬਹੁਤ ਚੰਗਾ ਰਹਿੰਦਾ ਹੈ ਐਰੋਬਿਕਸ ਦੇ ਬਹੁਤ ਸਾਰੇ ਫਾਇਦੇ ਆ ਇਸ ਨਾਲ ਭਾਰ ਘੱਟ ਜਾਂਦਾ ਹੈ ਇਸ ਨੂੰ ਲਗਾਤਾਰ ਦਸ ਮਿੰਟ ਕਰਨ ਨਾਲ ਕੀਤਾ ਜਾਵੇ ਤਾਂ ਇਹ ਸਾਡੇ ਸਰੀਰ ਵਿੱਚੋਂ ਸਰੀਰ ਨੂੰ ਸਫੁਰਤੀ ਪ੍ਰਦਾਨ ਕਰਦਾ ਇਸ ਨਾਲ ਅਸੀਂ ਹਮੇਸ਼ਾ ਐਕਟਿਵ ਰਹਿੰਦੇ ਹਾਂ

ਇਸ ਨਾਲ ਸਾਨੂੰ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਇਸ ਨਾਲ ਇਹ ਕਰਨ ਨਾਲ ਸਾਡੇ ਮਨ ਵਿੱਚੋਂ ਮੈਲੇ ਪਦਾਰਥ ਦੂਰ ਹੁੰਦੇ ਹਨ ਭੰਗੜਾ ਕਰਨ ਨਾਲ ਸਾਨੂੰ ਭੰਗੜਾ ਐਰੋਬਿਕਸ ਨਾਲ ਸਾਡੇ ਜੀਵਨ ਜਾਂ ਸਿਹਤ ਨੂੰ ਬਹੁਤ ਸਾਰੀ ਪ੍ਰਭਾਵ ਪ੍ਰਭਾਵ ਪੈਂਦੇ ਹਨ